ਭੰਗੜੇ ਦੇ ਤੇਜ਼ ਤਾੜੀ ਝੂਮਰ ਪਟਾਕਾ ਡਬਲ ਜੱਫਾ ਖਿੱਚਾ ਫੁਲਕਾ ਆਦਿ ਮੇਨ ਸਟੈਪ ਹਨ ਇਹ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਧਾ ਸੁਭਾਅ ਵਿੱਚ ਅਹਿਮ ਯੋਗਦਾਨ ਪ੍ਰਦਾਨ ਕਰਦੇ ਹਨ ਇਹ ਭੰਗੜੇ ਨੂੰ ਹੋਰ ਰੋਮਾਂਚਕ ਬਣਾ ਦਿੰਦੇ ਹਨ ਜਿਸ ਨਾਲ ਆਸੇ ਪਾਸੇ ਦਾ ਮਾਹੌਲ ਜਸ਼ਨਮਈ ਬਣ ਜਾਂਦਾ ਹੈ ਭੰਗੜਾ ਪਾਉਣ ਨਾਲ ਸਾਡਾ ਸਰੀਰ ਖੁੱਲ੍ਹ ਜਾਂਦਾ ਹੈ ਅਤੇ ਜੋਸ਼ ਵਿੱਚ ਆ ਜਾਂਦਾ ਹੈ ਜਦੋਂ ਅਸੀਂ ਇਸ ਜੋਸ਼ ਵਿੱਚ ਹੁੰਦੇ ਹਾਂ ਤਾਂ ਸਾਡੇ ਅੰਦਰੋਂ ਰੂਹ ਖੁਸ਼ ਹੋ ਕੇ ਨੱਚਣ ਲੱਗ ਜਾਂਦੀ ਹੈ ਆਮ ਤੌਰ 'ਤੇ ਭੰਗੜਾ ਪੰਜਾਬੀ ਲੋਕ ਨਾਚ ਹੈ ਜਿਸ ਨੂੰ ਕਿਸਾਨਾ ਵੱਲੋਂ ਵਿਸਾਖੀ ਦੇ ਮਹੀਨੇ ਵਿੱਚ ਕਣਕ ਪੱਕਣ ਦੀ ਖੁਸ਼ੀ ਵਿੱਚ ਪਾਇਆ ਜਾਂਦਾ ਹੈ ਪਰ ਅੱਜ ਕੱਲ੍ਹ ਇਸਨੂੰ ਵਿਆਹ ਸ਼ਾਦੀਆਂ ਵਿੱਚ ਵੀ ਅਤੇ ਸਕੂਲਾਂ ਕਾਲਜਾਂ ਵਿੱਚ ਕੰਪੀਟੀਸ਼ਨਾਂ ਵਿੱਚ ਵੀ ਪਾਇਆ ਜਾਂਦਾ ਹੈ ਕਿਉਂਕਿ ਭੰਗੜਾ ਪੰਜਾਬੀ ਲੋਕ ਨਾਚ ਦਾ ਸੱਭਿਆਚਾਰਕ ਨਾਚ ਹੈ ਭੰਗੜਾ ਹਰ ਇੱਕ ਈਵੈਂਟ ਨੂੰ ਜਸ਼ਨਮਈ ਬਣਾ ਦਿੰਦਾ ਹੈ ਅਤੇ ਚਾਰ ਚੰਦ ਲਗਾ ਕੇ ਰੌਣਕਾਂ ਲਗਾ ਦਿੰਦਾ ਹੈ ਜਿਸ ਨਾਲ ਆਸੇ ਪਾਸੇ ਦਾ ਮਾਹੌਲ ਬਹੁਤ ਜਸ਼ਨਮਈ ਅਤੇ ਰੋਮਾਂਚਕ ਬਣ ਜਾਂਦਾ ਹੈ